ਖੇਡਾਂ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਆ ਚੁਸਤਪਨ ਆਉਂਦਾ ਆ ਫੁਰਤੀਲਾਪਨ ਆਉਂਦਾ ਲਚਕੀਲਾਪਨ ਆਉਂਦਾ ਅਤੇ ਇਹ ਲਗਾਤਾਰ ਐਕਟੀਵਿਟੀ ਦੇ ਰਹਿਣ ਦੇ ਐਕਟੀਵਿਟੀ ਦੇ ਵਿੱਚ ਰਹਿਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਆ ਉਹ ਤਾਜ਼ਗੀ ਬਣੀ ਰਹਿੰਦੀ ਆ ਸਾਡੇ ਦਿਮਾਗ ਦੀਆਂ ਨਸਾਂ ਜਿਹੜੀਆਂ ਨੇ ਉਹ ਲਗਾਤਾਰ ਐਕਟੀਵਿਟੀ ਅਦਾਨ ਪ੍ਰਦਾਨ ਕਰਦੀਆਂ ਰਹਿੰਦੀਆਂ ਨੇ ਔਰ ਜਿਸਦੇ ਨਾਲ ਸਾਡਾ ਸਰੀਰ ਬਹੁਤ ਸਾਰੇ ਮਾਨਸਿਕ ਰੋਗਾਂ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਆ ਅਤੇ ਇਸ ਦੇ ਨਾਲ ਸਾਡੇ ਦਿਮਾਗ ਦੀਆਂ ਜਿਹੜੀਆਂ ਨਸਾਂ ਨੇ ਉਹ ਵੀ ਠੀਕ ਰਹਿੰਦੀਆਂ ਨੇ ਸਾਡੇ ਦਿਮਾਗ ਜਿਹੜਾ ਆ ਉਹ ਚੰਗਾ ਚੱਲਦਾ ਹੈ ਸਾਡਾ ਦਿਮਾਗ ਤੇਜ਼ ਹੁੰਦਾ ਆ ਅਤੇ ਇਸ ਦੇ ਨਾਲ ਅਸੀਂ ਬਹੁਤ ਸਾਰੀ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਅਤੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਅਸੀਂ ਖੇਡਾਂ ਦੇ ਨਾਲ ਤੰਦਰੁਸਤ ਰਹਿੰਦੇ ਹਾਂ